ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਡਮ ਏਬੀਸੀ ਬੱਸ ਸਰਵਿਸ ਤੋਂ ਬੋਲ ਰਿਹਾ ਜੀ ਹਾਂਜੀ ਮੈਡਮ ਸਾਡੀ ਵੋਲਵੋ ਬਸ ਸਰਵਿਸ ਹੈਗੀ ਆ ਪਰ ਤੁਸੀਂ ਕਿੱਥੇ ਵਾਸਤੇ ਦੇਖ ਰਹੇ ਓ ਮੈਡਮ ਬਿਲਕੁਲ ਮੈਡਮ ਦਿੱਲੀ ਵਾਸਤੇ ਸਾਡੀ ਏਸੀ ਬੱਸ ਸਰਵਿਸ ਹੈਗੀ ਆ ਵੋਲਵੋ ਦੀ ਮੈਡਮ ਸਾਡੀ ਦਿੱਲੀ ਵਾਸਤੇ ਜਿਹੜੀਆਂ ਹੈਗੀਆਂ ਦੋ ਬੱਸਾਂ ਜਾਂਦੀਆਂ ਜੀ ਰੋਜ਼ ਦੀਆਂ ਇੱਕ ਸਵੇਰੇ ਛੇ ਵਜੇ ਅਤੇ ਇੱਕ ਰਾਤੀ ਅੱਠ ਵਜੇ ਨਿਕਲਦੀ ਹੈ ਕਪੂਰਥਲਾ ਬਸ ਸਟੈਂਡ ਤੋਂ ਜਿਹੜੀ ਸਾਡੀ ਸਵੇਰੇ ਛੇ ਵਜੇ ਜਾਂਦੀ ਹੈ ਜੀ ਉਹ ਥਰੀ ਬਾਏ ਟੂ ਆ ਅਤੇ ਜਿਹੜੀ ਰਾਤੀ ਸਾਡੀ ਚਲਦੀ ਹੈਗੀ ਅੱਠ ਵਜੇ ਉਹ ਟੂ ਬਾਏ ਟੂ ਹੈ ਜੀ ਨਹੀਂ ਨਹੀਂ ਮੈਡਮ ਡੇਲੀ ਚੱਲਦੀ ਹੈ ਜੀ ਡੇਲੀ ਸਵੇਰੇ ਸਵੇਰੇ ਛੇ ਵਜੇ ਅਤੇ ਅੱਠ ਵਜੇ ਰਾਤੀ ਜਾਂਦੀ ਆ ਜੀ ਕਪੂਰਥਲਾ ਬਸ ਸਟੈਂਡ ਤੋਂ ਹਾਂ ਮੈਡਮ ਐਕਚੁਲੀ ਸਾਡਾ ਜਿਹੜਾ ਹੁੰਦਾ ਹੈ ਸਾਰੀ ਟਿਕਟ ਜਿਹੜੀਆਂ ਹੈਗੀਆਂ ਪਹਿਲਾਂ ਹੀ ਬੁੱਕ ਹੋ ਜਾਂਦੀਆਂ ਅਤੇ ਟਿਕਟ ਦੀ ਅਵੇਲੇਬਿਲਟੀ ਵਾਸਤੇ ਤੁਹਾਨੂੰ ਆਨਲਾਈਨ ਸਾਡੀ ਵੈਬਸਾਈਟ 'ਤੇ ਵਿਜਿਟ ਕਰਕੇ ਬੁਕਿੰਗ ਕਰਨੀ ਪਏਗੀ ਅਤੇ ਸਾਡੀ ਵੈਬਸਾਈਟ ਤੁਸੀਂ ਨੋਟ ਕਰ ਲਓ ਇਹ ਹੈ ਜੀ ਡਬਲਿਊ ਡਬਲਿਊ ਡਬਲਿਊ ਡੋਟ ਏਬੀਸੀ ਬੱਸ ਸਰਵਿਸ ਡੋਟ ਕੋਮ ਨਹੀਂ ਮੈਡਮ ਉਹ ਸੈਮੀ ਸਲੀਪਰ ਕਹਿੰਦੇ ਨੇ ਜੀ ਟੂ ਬਾਏ ਟੂ ਉਹਦੀਆਂ ਸੀਟਜ ਜਿਹੜੀਆਂ ਹੈਗੀਆਂ ਰਿਕਲਾਈਨਰ ਹੁੰਦੀਆਂ ਸਲੀਪਰ ਨਹੀਂ ਹੈ ਜੀ

ਜਿਹੜੀ ਮੈਮ ਸਵੇਰ ਵਾਲੀ ਹੈਗੀ ਆ ਉਹਦੇ ਤੁਹਾਡੇ ਹੈਗੇ ਜੀ ਇੱਕ ਜਣੇ ਦੇ ਅੱਠ ਸੌ ਪੰਜਾਹ ਰੁਪਏ ਉਹਦੇ ਮੈਡਮ ਇੱਕ ਹਜ਼ਾਰ ਪੰਜਾਹ ਰੁਪਏ ਹਾਂਜੀ ਮੈਡਮ ਕਟੜੇ ਵਾਸਤੇ ਵੀ ਹੈਗੀ ਆ ਸਾਡੀ ਬਸ ਸਰਵਿਸ ਦੇਖੋ ਮੈਡਮ ਸ ਨੋਨ ਸਟੋਪ ਵੈਸੇ ਉਦਾਂ ਤਾਂ ਨੋਨ ਸਟੋਪ ਹੀ ਆ ਬਟ ਇਹ ਆ ਕਿ ਜਿੱਦਾਂ ਬੁਕਿੰਗ ਕਿਸੇ ਨੇ ਲਈ ਹੁੰਦੀ ਹੈ ਮੰਨ ਲਓ ਪਠਾਨਕੋਟ ਤੋਂ ਜਾਂ ਜੰਮੂ ਤੋਂ ਉਹਦੇ ਵਾਸਤੇ ਅਸੀਂ ਫਿਰ ਇੱਕ ਓਨ ਦਾ ਵੇ ਸਟੋਪਿਜ ਹੈਗੇ ਸਾਡੇ ਅਸੀਂ ਬੱਸ ਸਟੈਂਡ ਦੇ ਵਿੱਚ ਨਹੀਂ ਜਾਂਦੀ ਸਾਡੀ ਬੱਸ ਮੈਡਮ ਲਗਭਗ ਸਾਢੇ ਤਿੰਨ ਵਜੇ ਤੁਹਾਨੂੰ ਦਿੱਲੀ ਕਸ਼ਮੀਰੀ ਗੇਟ ਆਈ ਐਸ ਬੀ ਟੀ ਉਤਾਰ ਦਵੇਗੀ ਜੀ ਹੋਰ ਕੋਈ ਜਾਣਕਾਰੀ ਮੈਡਮ ਤੁਸੀਂ ਚਾਹੋਂਗੇ ਜੀ ਸਾਡੇ ਵੱਲੋਂ ਅੰਮ੍ਰਿਤਸਰ ਲਈ ਮੈਮ ਬਹੁਤ ਹੈ ਜੀ ਰੋਜ਼ ਦੀਆਂ ਚਾਰ ਜਾਂਦੀਆਂ ਜੀ ਸਾਡੀਆਂ ਵੋਲਵੋ ਹਾਂਜੀ ਮੈਡਮ ਇੱਕ ਸਵੇਰੇ ਛੇ ਵਜੇ ਇੱਕ ਉਸ ਤੋਂ ਬਾਅਦ ਦਸ ਵਜੇ ਜਾਂਦੀ ਹੈ ਜੀ ਫਿਰ ਦੁਪਹਿਰੇ ਤਿੰਨ ਵਜੇ ਫਿਰ ਰਾਤੀ ਨੌਂ ਵਜੇ ਜੀ ਰਾਤੀ ਨੌਂ ਵਜੇ ਓਕੇ ਮੈਡਮ ਜੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ ਧੰਨਵਾਦ ਜੀ